ਬਜ਼ਾਰੋਂ ਲਿਆਂਦੇ ਕੱਪੜੇ ਅਤੇ ਘਰ ਸੀਤੇ ਕੱਪੜਿਆਂ ਵਿੱਚ ਬਹੁਤ ਫਰਕ ਹੁੰਦਾ ਹੈ ਕਿਉਂਕਿ ਬਜਾਰੋਂ ਵਿੱਚੋਂ ਲਿਆਂਦੇ ਕੱਪੜਿਆਂ ਦੀ ਕਈ ਵਾਰ ਫੀਟਿੰਗ ਵੀ ਨਹੀਂ ਹੁੰਦੀ ਜਿਹਦੇ ਕਰਕੇ ਸਾਨੂੰ ਉਹ ਕੱਪੜਿਆਂ ਨੂੰ ਬਾਹਰੋਂ ਠੀਕ ਕਰਵਾਉਣਾ ਪੈਂਦਾ ਹੈ ਜਿਹਦੇ ਨਾਲ ਸਾਨੂੰ ਇੱਕ ਤਾਂ ਸਾਨੂੰ ਸਾਡੇ ਪੈਸੇ ਬਰਬਾਦ ਹੁੰਦੇ ਹਨ ਅਤੇ ਦੂਜਾ ਸਾਡਾ ਸਮਾਂ ਵੀ ਖਰਾਬ ਹੁੰਦਾ ਹੈ ਉਹ ਹੀ ਜੇ ਅਸੀਂ ਇੰਟਰਨੈੱਟ ਤੋਂ ਸਿੱਖ ਕੇ ਆਪ ਸਿਲਾਈ ਘਰ ਕ ਕਰ ਲਈਏ ਇਸ ਨਾਲ ਸਾਡਾ ਇੱਕ ਤਾਂ ਸਾਡਾ ਇਹ ਫਾਇਦਾ ਕੇ ਸਾਨੂੰ ਸਿਲਾਈ ਕਰਨੀ ਆ ਜਾਂਦੀ ਹੈ ਦੂਜਾ ਇਹ ਸਾਡੇ ਪੈਸੇ ਬਚਦੇ ਹਨ ਅਤੇ ਸਮਾਂ ਬਚਦਾ ਹੈ ਸਾਨੂੰ ਜਿੱਦਾਂ ਦਾ ਸੂਟ ਦਾ ਡਿਜ਼ਾਇਨ ਚਾਹੀਦਾ ਹੈ ਅਸੀਂ ਉੱਦਾਂ ਦਾ ਬਣਾ ਸਕਦੇ ਹਾਂ